ਰੂਪਨਗਰ ਜ਼ਿਲ੍ਹੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜਿਵੇਂ ਕਿ ਕੂੜਾ ਕਰਕਟ ਜਿਵੇਂ ਕੂੜਾ ਕਰਕਟ ਵਿੱਚ ਲੋਕ ਅੱਜ ਵੀ ਮਤਲਬ ਕਿ ਬਾਹਰ ਕੂੜਾ ਸੁੱਟਦੇ ਨੇ ਮਤਲਬ ਸਰਕਾਰ ਨੇ ਉਨ੍ਹਾਂ ਦੇ ਘਰ ਘਰ ਘਰ ਡਸਟਬਿਨ ਉਪਲਬਧ ਕਰਵਾਏ ਨੇ ਉਹ ਉਹ ਇੱਦਾਂ ਹੀ ਉਹ ਬਾਹਰ ਕੂੜਾ ਕਰਕਟ ਹਾਲੇ ਵੀ ਸੁੱਟੀ ਜਾਂਦੇ ਨੇ ਚੁਣੌਤੀਆਂ ਚੁਣੌਤੀਆਂ ਜਿਵੇਂ ਕਿ ਹੁਣ ਅੱਜ ਕੱਲ੍ਹ ਲੋਕ ਹੈ ਉਨ੍ਹਾਂ ਨੂੰ ਘਰ ਘਰ ਡਸਟਬਿਨ ਦਿੱਤੇ ਨੇ ਬਟ ਉਹ ਅੱਜ ਵੀ ਹੁਣ ਬਾਹਰ ਕੂੜਾ ਕਰਕਟ ਸਿਟੀ ਜਾਂਦੇ ਨੇ ਅਤੇ ਉਹ ਗੰਦਗੀ ਫੈਲਾ ਰਹੇ ਨੇ ਇੱਦਾਂ ਹੀ ਉਹ ਸਾਰੇ ਸ਼ਹਿਰ ਨੂੰ ਦੂਸ਼ਿਤ ਕਰ ਰਹੇ ਨੇ ਜੇ ਆਪਾਂ ਗੱਲ ਕਰੀਏ ਕੁਦਰਤੀ ਸਰੋਤ ਦੀ ਕੁਦਰਤੀ ਸਰੋਤ ਵਿੱਚ ਜਿਵੇਂ ਆਪਣੇ ਸਤਲੁਜ ਦਰਿਆ ਆ ਰਿਹਾ ਸਤਲੁਜ ਦਰਿਆ ਨੂੰ ਅ ਉਹ ਦੂਸ਼ਿਤ ਕਰਦੇ ਨੇ ਪਾਣੀ ਦੂਸ਼ਿਤ ਹੋ ਰਿਹਾ ਆਪਣਾ ਪਾਣੀ ਦੂਸ਼ਿਤ ਹੋ ਰਿਹਾ ਅਤੇ ਪਾਣੀ ਆਪਣਾ ਇਹ ਸਤਲੁਜ ਦਰਿਆ ਜਾ ਕੇ ਰਾਜਸਥਾਨ ਵਿੱਚ ਮਿਲਦਾ ਹੈ ਅਤੇ ਜੋ ਸਾਰੇ ਵਿੱਚ ਲੱਗ ਰਹੇ ਨੇ ਏਰੀਏ ਇਹ ਸਾਰੇ ਏਰੀਏ ਵਿੱਚ ਦੂਸ਼ਿਤ ਪਾਣੀ ਜਾਏਗਾ ਅਤੇ ਉਹ ਲੋਕ ਬਿਮਾਰ ਹੋਣਗੇ ਇਸ ਪਾਣੀ ਸਿੰਚਾਈ ਲਈ ਵੀ ਵਰਤਿਆ ਜਾਂਦਾ ਹੈ ਇਸ ਲਈ ਇਹ ਸਾਰਾ ਸਾਡੇ ਫ਼ਸਲਾਂ ਵਿੱਚ ਆ ਕੇ ਅਤੇ ਸਾਡੀ ਫ਼ਸਲਾਂ ਨੂੰ ਖਰਾਬ ਕਰਦਾ ਏ ਅਤੇ ਸਾਡੇ ਅਨਾਜ ਵਿੱਚ ਆ ਰਿਹਾ ਗੱਲ ਕਰੀਏ ਤਾਂ ਆਪਣੇ ਸਿੱਖ ਇਤਿਹਾਸ ਵਿੱਚ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੀ ਲਾਈਨ ਆਉਂਦੀ ਏ ਜਿਸ ਨਾਲ ਇਹ ਸਾਨੂੰ ਚਾਹੀਦਾ ਹੈ ਅਸੀਂ ਕੁਦਰਤ ਦੀ ਸੰਭਾਲ ਕਰੀਏ